ਸਤਿ ਸ਼੍ਰੀ ਅਕਾਲ ਜੀ ਮੈਂ ਕਾਲ ਕੀਤਾ ਮੈਂ ਆਪਣੇ ਕਨੇਡਾ ਜਾਣ ਲਈ ਰਿਕੁਇਰਮੈਂਟ ਦਾ ਪਤਾ ਕਰਨਾ ਸੀ ਕਨੇਡਾ ਜਾਣ ਲਈ ਕਿੰਨੇ ਬੈਂਡ ਚਾਹੀਦੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ

ਓਕੇ ਜੀ ਇਹਨੂੰ ਕਰਨ ਲਈ ਟਾਈਮ ਕਿੰਨਾ ਲੱਗ ਜਾਂਦਾ ਮੈਮ ਕਿੰਨੇ ਕੁ ਮੰਥ ਲੱਗ ਜਾਣਗੇ ਮੈਨੂੰ ਦੱਸਦੇ ਹਾਂਜੀ ਏਟੀ ਪਰ ਏਟੀ ਪ੍ਰਸੈਂਟ ਹਾਂਜੀ ਹਾਂਜੀ ਸੀ ਬੀ ਐੱਸ ਸੀ ਬੋਰਡ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ